ਟੈਕਨੋਲਜੀ ਨੇ ਟਰਾਂਸਪੋਟੇਸ਼ਨ ਨੂੰ ਅਸਾਨ ਬਣਾਉਣ ਵਿੱਚ ਬਹੁਤ ਮਦਦ ਕੀਤੀ ਹੈ ਟਰਾਂਸਪੋਟੇਸ਼ਨ ਦੇ ਰਸਤੇ ਓਨਲਾਈਨ ਹੋਣ ਕਾਰਨ ਸਾਨੂੰ ਟਰਾਂਸਪੋਟੇਸ਼ਨ ਬੁਕਿੰਗ ਦੇ ਲਈ ਕਿਸੇ ਵੀ ਲਾਈਨ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਹੈ ਕਿਸੇ ਵੀ ਚੀਜ਼ ਦੀ ਬੁਕਿੰਗ ਅਸੀਂ ਆਪਣੇ ਘਰ ਬੈਠੇ ਓਨਲਾਈਨ ਹੀ ਕਰ ਸਕਦੇ ਹਾਂ ਇਸ ਨਾਲ ਸਾਡੇ ਸਮੇਂ ਦੀ ਬਹੁਤ ਬਚਤ ਹੁੰਦੀ ਹੈ ਅਸੀਂ ਕਿਸੇ ਵੀ ਚੀਜ਼ ਦੀ ਬੁਕਿੰਗ ਆਪਣੇ ਘਰ ਬੈਠੇ ਸ਼ਡਿਉਲ ਕਰ ਸਕਦੇ ਹਾਂ ਅਤੇ ਕਿਹੜਾ ਵਾਹਨ ਕਿਹੜੇ ਸਥਾਨ ਦੇ ਲਈ ਐਵੀਲੇਵਲ ਹੈ ਜਾਂ ਨਹੀਂ ਉਹ ਸਾਨੂੰ ਘਰ ਬੈਠੇ ਹੀ ਪਤਾ ਲੱਗ ਜਾਂਦਾ ਹੈ